ਤੇਰਾਂ ਅਪ੍ਰੈਲ ਸੋਲਾਂ ਸੌ ਨੜਿਨਵੇਂ ਛੇ ਜੂਨ ਉੱਨੀ ਸੌ ਚੁਰਾਸੀ ਚਾਰ ਜੂਨ ਦੋ ਹਜ਼ਾਰ ਇੱਕ ਪੰਜ ਜਨਵਰੀ ਦੋ ਹਜ਼ਾਰ ਗਿਆਰਾਂ ਬਾਰਾਂ ਜੂਨ ਦੋ ਹਜ਼ਾਰ ਵੀਹ